ਦਾਜ ਪ੍ਰਥਾ ਹੁਣ ਜਿਹੜੇ ਅੱਜ ਕੱਲ੍ਹ ਦੇ ਵਿੱਚ ਬੜੀ ਘੱਟਦੀ ਜਾ ਰਹੀ ਹੈ ਲੋਕੀਂ ਲੜਕੀਆਂ ਨੂੰ ਵਿਆਹ ਹੀ ਵਿਆਹ ਪੜ੍ਹਾ ਹੀ ਪੜ੍ਹਾ ਹੀ ਇੰਨਾ ਦਿੰਦੇ ਹਨ ਕਿ ਉਹਨੂੰ ਪੂਰੇ ਉਹਦੇ ਆਪਣੇ ਪੈਰਾਂ ਸਿਰ ਖੜਾ ਕਰ ਦਿੱਤਾ ਜਾਂਦਾ ਹੈ ਅਤੇ ਤਾਂ ਜੋ ਲੜਕੀ ਦੇ ਅਸੀਂ ਵਿਆਹ ਦੇ ਵਿੱਚ ਫੈ ਜਿਹੜਾ ਪੈਸਾ ਹੈਗਾ ਅੱਜ ਕੱਲ੍ਹ ਬਹੁਤ ਘੱਟ ਲਗਾਇਆ ਜਾਂਦਾ ਹੈ ਜੋ ਕਿ ਇੱਕ ਬੜੀ ਵਧੀਆ ਸਿਆਣਪ ਵਾਲੀ ਗੱਲ ਹੈ ਜਿਹੜੀ ਲੜਕੀ ਦੀ ਕੁਆਲੀਕੇਸ਼ਨ ਹੀ ਹੈ ਉਹੀ ਅਸਲੀ ਉਹਦਾ ਦਾਜ ਹੈ ਧੰਨਵਾਦ